ਹੈਲੋ ਹਾਂਜੀ ਨਮਸਤੇ ਭਾਅ ਜੀ ਮੈਂ ਮਨੀਸ਼ਾ ਬੋਲ ਰਹੀ ਹਾਂ ਹਾਂਜੀ ਭਾਅ ਜੀ ਮੈਂ ਨਾ ਸਵਿਗੀ 'ਤੇ ਤੁਹਾਡੀ ਰੈਗੂਲਰ ਕਸਟਮਰ ਹਾਂ ਮੇਰੇ ਕੋਲੋਂ ਨਾ ਕੁਛ ਗਲਤੀ ਨਾਲ ਤੁਹਾਡੇ ਕਾਰਟ ਦੇ ਵਿੱਚ ਨਾ ਕੁਛ ਆਈਟਮਾਂ ਹੋ ਗਈਆਂ ਨੇ ਸਿਲੈਕਟ ਉਹਨਾਂ ਨੂੰ ਨਾ ਮੇਰੇ ਕੋਲੋਂ ਡਿਲੀਟ ਨਹੀਂ ਕੀਤੀਆਂ ਜਾ ਰਹੀਆਂ ਅਤੇ ਮੈਂ ਉਹਨਾਂ ਨੂੰ ਖਰੀਦਣਾ ਵੀ ਨਹੀਂ ਗਾ ਬੱਚੇ ਪਤਾ ਕੀ ਕਰਦੇ ਬਾਰ ਬਾਰ ਦੇਖਦੇ ਆ ਅਤੇ ਜਿੱਦ ਕਰਦੇ ਆ ਕਿ ਉਹ ਔਡਰ ਕਰਕੇ ਮੰਗਵਾਓ ਅਤੇ ਮੈਨੂੰ ਨਾ ਉੱਥੋਂ ਹਟਾਉਣਾ ਨਹੀਂ ਆ ਰਿਹਾ ਕਿ ਕਾਰਡ ਤੋਂ ਕਿਸ ਤਰ੍ਹਾਂ ਉਹਨਾਂ ਨੂੰ ਹਟਾਵਾਂ ਤਾਂ ਕਿ ਇਹਨਾਂ ਦਾ ਵੀ ਧਿਆਨ ਇੱਧਰ ਉੱਧਰ ਹੋਵੇ ਪਲੀਜ਼ ਭਾਅ ਜੀ ਮੈਨੂੰ ਤੁਹਾਡੀ ਹੈਲਪ ਦੀ ਲੋੜ ਹੈ ਅਤੇ ਮੇਰਾ ਜਿਹੜਾ ਨੰਬਰ ਹੈਗਾ ਨਾ ਉਹ ਫਾਈਵ ਏਟ ਸਿਕਸ ਟੂ ਸਿਕਸ ਵੰਨ ਹੈਗਾ ਜੇ ਹਾਂਜੀ ਅਤੇ ਇਥੋਂ ਪਲੀਜ਼ ਭਾਅ ਜੀ ਤੁਸੀਂ ਇਹਨੂੰ ਰਿਮੂਵ ਕਰ ਦਿਓ ਹਟਾ ਦਿਓ ਅਤੇ ਮੈਨੂੰ ਅੱਗੋਂ ਕਦੇ ਵੀ ਲੋੜ ਹੋਵੇਗੀ ਅਤੇ ਮੈਂ ਆਪੇ ਹੋਰ ਕਰਕੇ ਔਡਰ ਕਰਕੇ ਅਤੇ ਤੁਹਾਡੇ ਕੋਲੋਂ ਮੰਗਾ ਲਾਂਗੇ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ ਭਾਅ ਜੀ ਥੈਂਕ ਯੂ ਮੈਂ ਬੜੀ ਦੇਰ ਦੀ ਲੱਗੀ ਹੋਈ ਸੀ ਮੇਰੇ ਕੋਲੋਂ ਹੋ ਨਹੀਂ ਪਾ ਰਿਹਾ ਸੀ ਡਿਲੀਟ ਕਿ ਕਿਵੇਂ ਇਹਨਾਂ ਨੂੰ ਹਟਾਵਾਂ ਥੈਂਕ ਯੂ ਭਾਅ ਜੀ